ਹਾਂਜੀ ਸਰ ਮੈਂ ਤੁਹਾਡੇ ਰੈਸਟਰੋਰੇਂਟ ਤੋਂ ਇੱਕ ਔਡਰ ਦਿੱਤਾ ਸੀ ਜੋ ਕਿ ਥੋੜ੍ਹੇ ਸਮੇਂ ਪਹਿਲਾਂ ਹੀ ਕਰਿਆ ਸੀ ਜਿਸ ਵਿੱਚ ਦੋ ਨਿਊਡਲਸ ਦੀਆਂ ਪਲੇਟਾਂ ਤਿੰਨ ਬਰਗਰ ਅਤੇ ਤਿੰਨ ਗਾਰਲਿਕ ਬਰੈੱਡ ਸਨ ਪਰ ਹੁਣ ਮੈਂ ਉਸ ਵਿੱਚ ਥੋੜ੍ਹਾ ਜਿਹਾ ਬਦਲਾਓ ਚਾਹੁੰਦੀ ਹਾਂ ਜੇਕਰ ਹੋ ਸਕੇ ਤਾਂ ਜੋ ਗਾਰਲਿਕ ਬਰੈੱਡ ਸੀ ਤਿੰਨ ਦੀ ਜਗ੍ਹਾ ਦੋ ਕਰ ਦਿੱਤੀ ਜਾਵੇ ਅਤੇ ਬਰਗਰ ਵਿੱਚ ਦੀ ਕੁਆਂਟੀਟੀ ਵੀ ਘਟਾ ਕੇ ਦੋ ਕਰ ਦਿੱਤੀ ਜਾਵੇ ਜੇ ਤੁਸੀਂ ਇੱਦਾਂ ਕਰ ਸਕਦੇ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਵਾਂਗੇ